ਸਾਡੀ ਸਟੇਟ ਟਰਾਂਸਪੋਰਟ ਦੀ ਕੁਆਲਿਟੀ ਬਹੁਤ ਹੀ ਜ਼ਿਆਦਾ ਵਧੀਆ ਹੈ ਇਸ ਵਿੱਚ ਬੱਸਾਂ ਟ੍ਰੇਨਾਂ ਟੈਕਸੀ ਸਰਵਿਸ ਆਦਿ ਆਉਂਦੇ ਹਨ ਸਰਕਾਰ ਨੇ ਔਰਤਾਂ ਲਈ ਮੁਫਤ ਆਧਾਰ ਕਾਰਡ ਸੀਮ ਸਕੀਮ ਚਲਾਈ ਹੈ ਜਿਸ ਨਾਲ ਅਸੀਂ ਪੰਜਾਬ ਰੋਡਵੇਜ਼ ਪਨਬਸ ਅਤੇ ਪੀ ਆਰ ਟੀ ਪੀ ਆਰ ਟੀ ਸੀ ਬੱਸਾਂ ਵਿੱਚ ਮੁਫਤ ਸਫਰ ਦਾ ਪੀ ਆਰ ਟੀ ਸੀ ਬੱਸਾਂ ਵਿੱਚ ਆਧਾਰ ਕਾਰਡ ਚਲਾ ਕੇ ਮੁਫਤ ਸਫਰ ਕਰ ਸਕਦੇ ਹਾਂ